ਅੱਜ ਕੱਲ੍ਹ ਦੀ ਗੱਲ ਕਰੀਏ ਤਾਂ ਨਲ਼ਕੇ ਜਿਨ੍ਹਾਂ ਨੂੰ ਇੰਗ ਅੰਗਰੇਜ਼ੀ ਵਿੱਚ ਹੈਂਡਪੰਪ ਕਹਿੰਦੇ ਆ ਉਹ ਬਹੁਤ ਘੱਟ ਦਿਖਾਈ ਦਿੰਦੇ ਹਨ ਪਰ ਮੈਂ ਆਪਣੇ ਬਚਪਨ ਦੀ ਗੱਲ ਕਰਾਂ ਅਸੀਂ ਆਪਣੇ ਸਮੇਂ ਵਿੱਚ ਬਚਪਨ ਦੇ ਵਿੱਚ ਬੜੇ ਹੀ ਨਲ਼ਕਿਆਂ ਦੇ ਥੱਲੇ ਨਹਾਉਂਦੇ ਰਹੇ ਹਾਂ ਅਤੇ ਗਰਮੀਆਂ ਦੇ ਸਮੇਂ ਬੜਾ ਹੀ ਆਨੰਦ ਆਉਂਦਾ ਸੀ ਜਦੋਂ ਠੰਡਾ ਠੰਡਾ ਪਾਣੀ ਨਲ਼ਕੇ ਦਾ ਨਿਲਕਦਾ ਸੀ ਪਰ ਕਈ ਵਾਰੀ ਗਰਮੀਆਂ ਦੇ ਸਮੇਂ ਦੌਰਾਨ ਜਿਹੜਾ ਪਾਣੀ ਦਾ ਲੈਵਲ ਹੁੰਦਾ ਸੀਗਾ ਉਹ ਥੱਲੇ ਚਲੇ ਜਾਂਦਾ ਤਾ ਕਿਉਂਕਿ ਝੋਨੇ ਦੇ ਝੋਨੇ ਨੂੰ ਪਾਣੀ ਲਗਾਇਆ ਜਾਂਦਾ ਸੀਗਾ ਹੋਰ ਵੀ ਪਾਣੀ ਧਰਤੀ ਦਾ ਪਾਣੀ ਬਹੁਤ ਥੱਲੇ ਵਾਲੇ ਲੈਵਲ 'ਤੇ ਚਲਾ ਜਾਂਦਾ ਸੀਗਾ ਤਾਂ ਜਿਹੜਾ ਨਲ਼ਕਾ ਸੀਗਾ ਉਹ ਖੁਸ਼ਕ ਹੋ ਜਾਂਦਾ ਸੀਗਾ